ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਯੋਗਾ ਦੀ ਕਲਾਸ ਜੁਆਇਨ ਕੀਤੀ ਸੀਗੀ ਬਹੁਤ ਵੱਡਾ ਡਿਫਰੈਂਸ ਹੈਗਾ ਖੁਦ ਪ੍ਰੈਕਟਿਸ ਕਰਨ 'ਚ ਅਤੇ ਕਲਾਸ ਪ੍ਰੈਕਟਿਸ ਕਰਨ 'ਚ ਕਿਉਂਕਿ ਜਦੋਂ ਆਪਾਂ ਘਰੇ ਆਪਣੇ ਪ੍ਰੈਕਟਿਸ ਕਰਦੇ ਹਾਂ ਯੋਗਾ ਦੀ ਤਾਂ ਆਪਾਂ ਨੂੰ ਪ੍ਰੋਪਰ ਨਹੀਂ ਪਤਾ ਹੁੰਦਾ ਕਿ ਆਪਾਂ ਸਹੀ ਕਰ ਰਹੇ ਆਸਣ ਜਾਂ ਨਹੀਂ ਬਟ ਜਦੋਂ ਆਪਾਂ ਕਲਾਸ ਵਿੱਚ ਕੋਈ ਐਕਸਰਸਾਈਜ਼ ਜਾਂ ਔਗਾ ਯੋਗਾ ਕਰਦੇ ਹਾਂ ਤਾਂ ਆਪਾਂ ਨੂੰ ਟ੍ਰੇਨਰ ਹਰ ਟਾਈਮ ਟਾਈਮ ਟਾਈਮ 'ਤੇ ਗਾਈਡ ਕਰਦਾ ਰਹਿੰਦਾ ਉਸ ਤੋਂ ਇਲਾਵਾ ਜ਼ਿਆਦਾਤਰ ਦੇਖਣ 'ਚ ਆਉਂਦਾ ਕਿ ਯੋਗਾ ਕਰਨ ਤੋਂ ਪਹਿਲਾਂ ਆਪਾਂ ਪ੍ਰੋਪਰ ਵਾਮਅਪ ਨਹੀਂ ਹੁੰਦੇ ਬਟ ਟ੍ਰੇਨਰ ਜੋ ਹੁੰਦਾ ਕਲਾਸ ਵਿੱਚ ਉਹ ਇਸ ਗੱਲ ਦਾ ਪੂਰਾ ਧਿਆਨ ਦਿੰਦਾ ਔਰ ਇਸ ਤੋਂ ਇਲਾਵਾ ਘਰ ਆਪਾਂ ਜਦੋਂ ਕਰਦੇ ਹਾਂ ਯੋਗਾ ਤਾਂ ਆਪਾਂ ਓਵਰ ਵੀ ਕਰ ਕਰ ਦਿੰਦੇ ਹਾਂ ਕਈ ਵਾਰ ਜਿਸ ਨਾਲ ਆਪਣਾ ਕਈ ਵਾਰ ਮਸਲ ਪੁੱਲ ਹੋ ਜਾਂਦਾ ਆ ਅਤੇ ਹੋਰ ਪ੍ਰੋਬਲਮ ਆ ਜਾਂਦੀ ਹੈ ਬਟ ਕਲਾਸ ਵਿੱਚ ਅ ਇਹ ਇਹਨਾਂ ਸਾਰੀਆਂ ਚੀਜ਼ਾਂ 'ਤੇ ਧਿਆਨ ਦਿੱਤਾ ਜਾਂਦਾ ਔਰ ਇੱਕ ਇੱਕ ਗੱਲ ਨੂੰ ਨੋਟ ਕਰਕੇ ਨੋਟ ਕਰਕੇ ਆਪਾਂ ਨੂੰ ਪ੍ਰੋਪਰ ਗਾਈਡ ਕੀਤਾ ਜਾਂਦਾ ਬਹੁਤ ਵੱਡਾ ਡਿਫਰੈਂਸ ਹੈ ਕਲਾਸ ਔਰ ਘਰ ਬੈ ਘਰ ਬੈਠ ਕੇ ਪ੍ਰੈਕਟਿਸ ਕਰਨ 'ਚ